ਅਜਿਹੀਆਂ ਬਹੁਤ ਸਾਰੀਆਂ ਸਥਾਨਕ ਖੇਡਾਂ ਹਨ ਜਿਹਨਾਂ ਦਾ ਅਸੀਂ ਆਨੰਦ ਮਾਣਦੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਅਸੀਂ ਛੋਟੇ ਹੁੰਦੇ ਹੀ ਇੱਕ ਖੇਡ ਜੋ ਕਿ ਸਭ ਨੂੰ ਪਤਾ ਹੋਵੇਗਾ ਜਿਸਦਾ ਨਾਂ ਪੀਚੋ ਹੈ ਉਹ ਖੇਡ ਮੈਂ ਅਤੇ ਮੇਰੀ ਭੈਣ ਨੇ ਇੰਨੀ ਖੇਡੀ ਹੈ ਕਿ ਅਸੀਂ ਹੁਣ ਤੱਕ ਵੀ ਉਸ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ ਹੱਸਦੇ ਰਹਿੰਦੇ ਹਾਂ ਅਤੇ ਅੱਜ ਕੱਲ੍ਹ ਤਾਂ ਬਹੁਤ ਗੇਮਾਂ ਆ ਗਈਆਂ ਹਨ ਜਿਵੇਂ ਕਿ ਜੀ ਦੱਸ ਸਕਦੇ ਹਾਂ ਕਿ ਕੈਰਮ ਬੋਰਡ ਤਾਂ ਅੱਜ ਕੱਲ੍ਹ ਸਾਰੇ ਹੀ ਜਵਾਕਾਂ ਕੋਲ ਹੈ ਅਤੇ ਸ਼ਤਰੰਜ ਵੀ ਅੱਜ ਕੱਲ੍ਹ ਆਮ ਹੀ ਮਿਲ ਜਾਂਦੀ ਹੈ ਜੋ ਕਿ ਬੱਚੇ ਬਹੁਤ ਜ਼ਿਆਦਾ ਪਰ ਇਹ ਖੇਡਦੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਖੇਡਣ ਵਾਲੀ ਗੇਮ ਕੈਰਮ ਬੋਰਡ ਹੈ ਹਰੇਕ ਮੇਲੇ ਵਿੱਚੋਂ ਕੈਰਮ ਬੋਰਡ ਮਿਲ ਜਾਂਦਾ ਹੈ ਅਸੀਂ ਵੀ ਆਪਣੇ ਟਾਇਮ ਵਿੱਚ ਬਹੁਤ ਕੈਰਮ ਬੋਰਡ ਖੇਡਿਆ ਹੈ ਅਤੇ ਉਸ ਸਮੇਂ ਮੈਂ ਬੈਟਮਿੰਟਨ ਜਿਸ ਨੂੰ ਕਿ ਚਿੜੀ ਛਿੱਕਾ ਕਿਹਾ ਜਾਂਦਾ ਹੈ ਉਹ ਮੇਰਾ ਬਹੁਤ ਫੇਵਰੇਟ ਰਿਹਾ ਹੈ